ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਭੈਣ ਜੀ ਹਰਜਿੰਦਰ ਕੌਰ ਬੋਲਦੀ ਹੈ ਤੁਹਾਡੀ ਫਰੈਂਡ ਹਾਂਜੀ ਹਾਂਜੀ ਬਸ ਭੈਣ ਜੀ ਠੀਕ ਹੈ ਤੁਸੀਂ ਸੁਣਾਓ ਆਪਣੇ ਬੱਚਿਆਂ ਦਾ ਕਿਆ ਹਾਲ ਚਾਲ ਆ ਹਾਂਜੀ ਭੈਣ ਜੀ ਚਲੇ ਗਏ ਜੀ ਉਹ ਪਿਛਲੇ ਮਹੀਨੇ ਬਸ ਭੈਣ ਜੀ ਕੰਮਾਂ ਕਾਰਾਂ ਵਿੱਚ ਟਾਈਮ ਹੀ ਨਹੀਂ ਲੱਗਿਆ ਤੁਹਾਨੂੰ ਪਤਾ ਹੀ ਹੈ ਕਿੰਨੀ ਨੱਠ ਭੱਜ ਹੁੰਦੀ ਆ ਜਦ ਬੱਚਿਆਂ ਨੇ ਜਾਣਾ ਹੁੰਦਾ ਤੁਹਾਨੂੰ ਪਤਾ ਹੀ ਹੈ ਭੈਣ ਜੀ ਫਿਰ ਬਹੁਤ ਜ਼ਿਆਦਾ ਤੁਹਾਨੂੰ ਪਤਾ ਕਦੇ ਆਪਣੇ ਕਿਤੇ ਮਿਲਣ ਗਿਲਣ ਜਾਣਾ ਫਿਰ ਗੁਰਦੁਆਰਾ ਸਾਹਿਬ ਜਾਣਾ ਤੁਹਾਨੂੰ ਪਤਾ ਫਿਰ ਟਾਈਮ ਨਹੀਂ ਮਿਲਿਆ ਹੈਗਾ ਗੱਲ ਕਰਨ ਦਾ ਵੀ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਭੈਣ ਜੀ ਹੁਣ ਕੀ ਕਰਾਂ ਤੁਹਾਨੂੰ ਪਤਾ ਹੀ ਹੈ ਇੱਧਰ ਤਾਂ ਨੌਕਰੀਆਂ ਹੈ ਨਹੀਂ ਹੁਣ ਬੱਚਿਆਂ ਨੂੰ ਬਾਹਰ ਹੀ ਜਾਣਾ ਪੈਣਾ ਏ ਜੀ ਹਾਂਜੀ ਹਾਂਜੀ ਹਾਂਜੀ ਉਹ ਤਾਂ ਹੈ ਹੀ ਆ ਭੈਣ ਜੀ ਬਸ ਇਹੀ ਹੈ ਜੀ ਮ ਟਾਈਮ ਮਿਲਿਆ ਨਹੀਂ ਹੈਗਾ ਤੁਹਾਡੇ ਨਾਲ ਗੱਲ ਕਰਨ ਦਾ ਹਾਂ ਭੈਣ ਜੀ ਆਏ ਸੀ ਥੋੜ੍ਹੇ ਜਿਹੇ ਟਾਈਮ ਲਈ ਉਹ ਆਏ ਬਸ ਜਦੇ ਮੁੜ ਗਏ ਫਿਰ ਇੰਨਾਂ ਟਾਈਮ ਨਹੀਂ ਤਾ ਕੋਲ ਹੈਗਾ ਹਾਂਜੀ ਹਾਂਜੀ ਹਾਂਜੀ ਉਹ ਬਸ ਨੱਠ ਭੱਜ ਵਿੱਚ ਹੀ ਨਹੀਂ ਗਿਆ ਹੈਂ ਹਾਂਜੀ ਹਾਂਜੀ ਕੰਮ ਤਾਂ ਹੈ ਤਾਂ ਹੈਗਾ ਬੰਦਾ ਭੈਣ ਜੀ ਬੱਚਿਆਂ ਨੇ ਆਪਣਾ ਕੰਮ ਕਰ ਲਿਆ ਵਧੀਆ ਚੱਲਦਾ ਜੀ ਸਟੱਡੀ ਕਰੀ ਹੈ ਜੀ ਸਟੱਡੀ ਚੱਲਦੀ ਆ ਆਪਣਾ ਕਰੀ ਜਾਂਦੇ ਆ ਹਾਂਜੀ ਹਾਂਜੀ ਹਾਂਜੀ ਭੈਣ ਜੀ ਮਿਹਨਤ ਕਰਨੀ ਪੈਂਦੀ ਜਿਹੜਾ ਬੱਚਾ ਮਿਹਨਤੀ ਆ ਉਹ ਤਾਂ ਕਰ ਹੀ ਲੈਂਦਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਆਊਂਗੇ ਜੀ ਆਊਂਗੇ ਜ਼ਰੂਰ ਆਊਂਗੇ ਹਾਂਜੀ ਹਾਂਜੀ ਹਾਂਜੀ ਜ਼ਰੂਰ ਆਊਂਗੇ ਭੈਣ ਜੀ ਤੁਸੀਂ ਵੀ ਮਾਰਿਓ ਗੇੜਾ ਠੀਕ ਹੈ ਜੀ ਠੀਕ ਹੈ ਜੀ ਚੰਗਾ ਭੈਣ ਜੀ ਸਤਿ ਸ਼੍ਰੀ ਅਕਾਲ ਜੀ